ਸਾਡੇ ਘਰ ਦੀ ਰਸੋਈ ਵਿੱਚ ਵੱਖ ਵੱਖ ਪ੍ਰਕਾਰ ਦੇ ਕਈ ਬਰਤਨ ਹਨ ਸਾਡੇ ਘਰ ਵਿੱਚ ਤਵਾ ਹੈ ਜਿਸ 'ਤੇ ਅਸੀਂ ਰੋਟੀਆਂ ਪਕਾਉਂਦੇ ਹਾਂ ਸਾਡੇ ਘਰ ਵਿੱਚ ਚਕਲਾ ਅਤੇ ਵੇਲਣਾ ਵੀ ਹੈ ਜੋ ਕਿ ਰੋਟੀਆਂ ਵੇਲਣ ਦੇ ਕੰਮ ਆਉਂਦਾ ਹੈ ਸਾਡੇ ਘਰ ਇੱਕ ਪਰਾਤ ਹੈ ਜਿਸ ਵਿੱਚ ਅਸੀਂ ਆਟਾ ਗੁੰਨ ਲੈਂਦੇ ਹਾਂ ਅਤੇ ਕਈ ਵਾਰ ਉਸ ਪਰਾਤ ਸਾਗ ਆਦਿ ਹੋਰ ਕਈ ਸਬਜ਼ੀਆਂ ਕੱਟ ਵੀ ਲੈਂਦੇ ਹਾਂ ਸਾਡੇ ਘਰ ਪਤੀਲੇ ਵੀ ਬਹੁਤ ਹਨ ਛੋਟੇ ਤੋਂ ਲੈ ਕੇ ਵੱਡੇ ਆਕਾਰ ਤੱਕ ਦੇ ਕਈ ਪਤੀਲੇ ਸਾਡੇ ਘਰ ਹਨ ਪਤੀਲਿਆਂ ਵਿੱਚ ਅਸੀਂ ਦੁੱਧ ਰੱਖ ਲੈਂਦੇ ਹਾਂ ਅਤੇ ਦੁੱਧ ਉਬਾਲ ਵੀ ਲੈਂਦੇ ਹਾਂ ਕਈ ਵਾਰ ਪਤੀਲੇ ਵਿੱਚ ਦਾਲ ਚਾਵਲ ਆਦਿ ਚੀਜ਼ਾਂ ਵੀ ਬਣਾ ਲੈਂਦੇ ਹਾਂ ਸਾਡੇ ਘਰ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਕਈ ਆਕਾਰ ਦੀ ਕੜਾਹੀਆਂ ਵੀ ਹਨ ਛੋਟੀ ਕੜਾਹੀ ਵਿੱਚ ਅਸੀਂ ਤੜਕਾ ਲਗਾ ਲੈਂਦੇ ਹਾਂ ਅਤੇ ਛੋਟੀ ਕੜਾਹੀ ਸਬਜ਼ੀਆਂ ਗਰਮ ਕਰਨ ਦੇ ਕੰਮ ਵੀ ਆ ਜਾਂਦੀ ਹੈ ਵੱਡੀ ਕੜਾਹੀ ਦੇ ਵਿੱਚ ਸਬਜ਼ੀਆਂ ਮੈਗੀ ਸੇਵੀਆਂ ਕੜਾਹ ਸੀਰਾ ਆਦਿ ਚੀਜ਼ਾਂ ਬਣਾ ਲੈਂਦੇ ਹਾਂ ਹੋਰ ਸਾਡੇ ਘਰ ਵਿੱਚ ਪ੍ਰੈਸ਼ਰ ਕੁਕਰ ਵੀ ਹਨ ਇਹ ਕੁਕਰ ਅਸੀਂ ਸਬਜ਼ੀਆਂ ਬਣਾਉਣ ਵਿੱਚ ਵਰਤਦੇ ਹਾਂ ਸਾਡੇ ਘਰ ਵਿੱਚ ਥਾਲਾਂ ਪਲੇਟਾਂ ਕੋਲੀਆਂ ਚਮਚ ਆਦਿ ਬਰਤਨ ਹਨ ਜਿਨ੍ਹਾਂ ਦੇ ਵਿੱਚ ਅਸੀਂ ਖਾਣਾ ਪਰੋਸਦੇ ਹਾਂ ਸਾਡੇ ਘਰ ਦੇ ਵਿੱਚ ਇੱਕ ਪਤੀਲਾ ਹੈ ਜਿਸਦੇ ਵਿੱਚ ਅਸੀਂ ਚਾਹ ਬਣਾਉਂਦੇ ਹਾਂ ਅਤੇ ਕਈ ਕੱਪ ਹਨ ਜਿਸ ਦੇ ਵਿੱਚ ਅਸੀਂ ਚਾਹ ਪੀਂਦੇ ਹਾਂ